ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅ ਮੰਨਤ ਮੈਮ ਬੋਲ ਰਹੇ ਹੋ ਹਾਂਜੀ ਇੱਕ ਨਾ ਮੈਂ ਤੁਹਾਡਾ ਗੂਗਲ ਤੋਂ ਨੰਬਰ ਬ ਲੱਭਿਆ ਸੀ ਅਤੇ ਮੈਂ ਲੁਧਿਆਣੇ ਤੋਂ ਬੋਲ ਰਹੀ ਅਤੇ ਮੈਂ ਕਪੂਰਥਲਾ ਵਿਜਿਟ ਕਰਨਾ ਤੁਸੀਂ ਮੈਨੂੰ ਉਹਦਾ ਥੋੜ੍ਹੇ ਬਾ ਦੱਸ ਸਕਦੇ ਹੋ ਕਿ ਮੈਂ ਕਿੱਥੇ ਕਿਥੇ ਜਾ ਸਕਦੀ ਹਾਂ ਮੈਂ ਆਪਣੇ ਫਰੈਂਡਸ ਨਾਲ ਆਉਣਾ ਮੇਰਾ ਨਾਮ ਕ੍ਰਿਤੀ ਹੈ ਮੈਂ ਅਤੇ ਮੇਰੀ ਇੱਕ ਫਰੈਂਡ ਹੀ ਹੈ ਅਜੇ ਅਸੀਂ ਅਗਲੇ ਹਫ਼ਤੇ ਦਾ ਸੋਚ ਰਹੇ ਹਾਂ ਹਾਂਜੀ ਅਸੀਂ ਗੁਰਦੁਆਰੇ ਮੰਦਰ ਹੀ ਘੁੰਮਣਾ ਚਾਹੁੰਦੇ ਹਾਂ ਹੁੰ ਹਾਂਜੀ ਹਾਂਜੀ ਹਾਂਜੀ ਅਸੀਂ ਵੈਸੇ ਦੋ ਤਿੰਨ ਦਿਨ ਦਾ ਸੋਚਿਆ ਹੋਇਆ ਅਤੇ ਕੋਈ ਜਗ੍ਹਾ ਹੈਗੀ ਰਹਿਣ ਵਾਸਤੇ ਤਾਂ ਸਾਨੂੰ ਦੱਸ ਦਿਓ ਉਸਦੇ ਬਾਰੇ ਵੀ ਅੱਛਾ ਹੁੰ ਹੁੰ ਠੀਕ ਆ ਅਤੇ ਗੁਰਦੁਆਰਾ ਮਤਲਬ ਕਿੱਥੇ ਕੁ ਉਹ ਪੈਂਦਾ ਇੱਥੇ ਕਪੂਰਥਲਾ ਵਿੱਚ

ਅੱਛਾ ਠੀਕ ਆ ਹੁੰ

ਹੁੰ ਹੁੰ ਅੱਛਾ

ਠੀਕ ਹੈ ਇਹ ਸਾਰਾ ਘੁਮਾਉਣ ਵਾਸਤੇ ਤੁਸੀਂ ਚਾਰਜਸ ਕਿੰਨੇ ਲਓਂਗੇ ਲਾਈਕ ਅਸੀਂ ਦੋ ਤਿੰਨ ਦਿਨ ਵਾਸਤੇ ਹੀ ਆਵਾਂਗੇ ਜ਼ਿਆਦਾ ਨਹੀਂ

ਅੱਛਾ ਠੀਕ ਹੈ ਅਤੇ ਖਾਣ ਪੀਣ ਵਾਸਤੇ ਇੱਥੇ ਜਗ੍ਹਾ ਵਗੈਰਾ ਹੈਗੀ ਕੋਈ ਵਧੀਆ ਕਿੱਦਾਂ ਮਤਲਬ ਹੁੰ ਹੁੰ ਠੀਕ ਆ ਚਲੋ ਫਿਰ ਬਾਕੀ ਹੋਰ ਕੋਈ ਓ ਇੱਥੇ ਪ੍ਰਸਿੱਧ ਥਾਂ ਹੋਵੇ ਤਾਂ ਦੱਸੋ ਇੱਕ ਮੈਂ ਸੁਣਿਆ ਸੀ ਇੱਕ ਮੈਂ ਸੁਣਿਆ ਸੀ ਗੂਗਲ 'ਤੇ ਬੇਰ ਸਾਹਿਬ ਕਰਕੇ ਗੁਰਦੁਆਰਾ ਵੀ ਹੈਗਾ ਇੱਥੇ ਕੋਈ

ਅੱਛਾ ਅਤੇ ਉਹ ਕਿੰ ਕਿੰਨਾ ਕੁ ਦੂਰ ਹੈ ਠੀਕ ਆ ਅਤੇ ਅਸੀਂ ਜਾਣਾ ਕਿੱਦਾਂ ਮਤਲਬ ਕਾਰ ਰਾਹੀਂ ਕਿ ਕਿੱਦਾਂ ਦੱਸ ਦਿਓ ਥੋੜ੍ਹਾ ਠੀਕ ਆ ਚਲੋ ਠੀਕ ਹੈ ਫਿਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਅਗਲੇ ਹਫ਼ਤੇ ਦਾ ਤਾਂ ਸਾਡਾ ਪਲਾਨ ਹੈ ਵੈਸੇ ਤਾਂ ਹਾਂਜੀ ਹਾਂਜੀ ਹੁੰ ਹੁੰ ਹਾਂ ਹਾਂ ਮੈਂ ਭੇਜ ਦਿੰਦੀ ਹਾਂ ਹਾਂ ਮੈਂ ਭੇਜ ਦਿੰਦੀ ਚਲੋ ਠੀਕ ਹੈ ਨਾ ਸਤਿ ਸ਼੍ਰੀ ਅਕਾਲ ਥੈਂਕ ਯੂ ਠੀਕ ਹੈ ਓਕੇ